ਮੇਰੇ ਕੋਲ ਵੀ ਮੇਰੀ ਮਨਪਸੰਦ ਕਿਤਾਬ ਹੈ ਮਿਲਾਂਗੇ ਜ਼ਰੂਰ ਜੋ ਕਿ ਪ੍ਰੀਤ ਕੰਵਲ ਦੁਆਰਾ ਲਿਖੀ ਗਈ ਹੈ ਇਸ ਬੁੱਕ ਕਿਤਾਬ ਵਿੱਚ ਬਹੁਤ ਹੀ ਸਹੀ ਗੱਲਾਂ ਕੀਤੀਆਂ ਗਈਆਂ ਹਨ ਕਹਾਵਤਾਂ ਵੀ ਹਨ ਕਵਿਤਾਵਾਂ ਵੀ ਹਨ ਅਤੇ ਹੋਰ ਬਹੁਤ ਗੱਲਾਂ ਕੀਤੀਆਂ ਗਈਆਂ ਹਨ ਇਹ ਕਿਤਾਬ ਮੈਂ ਆਪਣੇ ਕੋਲੇਜ ਲੱਗੇ ਹੋਏ ਫੇਅਰ ਤੋਂ ਲਿੱਤੀ ਸੀ ਇਸ ਵਿੱਚ ਤੇਰੇ ਨਾਂ ਦੇ ਅੱਖਰ ਵੱਖ ਹੋਏ ਫੈਸਲੇ ਤੇਰੇ ਕੁਝ ਮਜਬੂਰ ਅਤੇ ਚੱਕਰ ਵਿੱਚ ਮੋਰੀ ਸਾਰੀ ਜ਼ਿੰਦਗੀ ਗੁਆਚੀ ਤੇਰੇ ਨਾਂ ਦੇ ਅੱਖਰ ਵਿੱਚ ਦਾਮਨ ਮੇਰੇ ਪੀੜਾਂ ਰੋਂਦੀਆਂ ਦੁੱਖ ਹਾਹਾਕਾਰ ਮਚਾਈ ਹਾਸੇ ਸਾਰੇ ਗਮ ਗਏ ਮੇਰੇ ਤੇਰੇ ਨਾਂ ਦੇ ਅੱਖਰ ਵਿੱਚ ਕਿੰਨੇ ਅਰਸੇ ਸੋਚਣ ਮਗਰੋਂ ਲਿਖੀ ਮੈਂ ਆਪਣੀ ਦਾਸਤਾਨ ਪੂਰੀ ਆ ਕੇ ਵਿੱਚ ਸਮਾ ਗਈ ਤੇਰੇ ਨਾਂ ਦੇ ਅੱਖਰ ਵਿੱਚ ਕੁਝ ਤਾਂ ਹੋਣਾ ਨਜ਼ਰ ਤੇਰੇ ਤੇਰੀ ਜੋ ਇਲਜ਼ਾਮ ਚਿੱਟਾ ਜਾਂ ਕਾਲਾ ਐਵੇਂ ਤਾਂ ਨਹੀਂ ਰੂਹ ਕਮਲੀਏ ਤੇਰੇ ਨਾਂ ਦੇ ਅੱਖਰ ਵਿੱਚ ਦੀਵਾ ਆਸ ਦਾ ਬੁਝਾਉਣ ਨਾ ਦੇਵਾਂ ਲੱਖ ਹਨੇਰੇ ਆਵੇ ਪਾ ਪਾ ਤੇਲ ਮੈਂ ਮਿਟਾਵਾਂ ਮਿਟਵਾਈਆਂ ਲਾਵਾਂ ਤੇਰੇ ਨਾਂ ਦੇ ਅੱਖਰ ਵਿੱਚ ਲੋਕ ਕੰਮਾਂ ਤੋਂ ਆਉਂਦੇ ਜਾਂਦੇ ਮਨ ਲਾਉਂਦੇ ਨੂੰ ਪੜ੍ਹਨ ਕਿਤਾਬਾਂ ਮੈਂ ਤਾਂ ਹਰ ਪਲ ਰੁੱਝਿਆ ਰਹਿੰਦਾ ਤੇਰੇ ਨਾਂ ਦੇ ਅੱਖਰ ਵਿੱਚ ਸਭ ਬਿੰਦ ਹੋਣ ਯਾਰ ਉੱਤੇ ਮੈਂ ਕੁਰਬਾਨ ਹੋਇਆ ਤਾਂ ਤੇਰੇ 'ਤੇ ਮੈਂ ਤਾਂ ਆਪਣੀ ਸੂਰਤ ਟਿਕਾ ਲਈ ਤੇਰੇ ਨਾਂ ਦੇ ਅੱਖਰ ਵਿੱਚ ਤੇਰਾ ਨਾਮ ਕਿੱਸਾ ਅਰਾਂ ਦੱਸਦਾ ਅਲ ਅਸਮਾਲਾ ਜ਼ਹਿਰੀ ਪੇੜਾ ਨੂੰ ਮੇਰਾ ਸਾਰਾ ਰਸਤਾ ਜੋ ਛੁਪਿਆ ਤੇਰੇ ਨਾਂ ਦੇ ਅੱਖਰ ਵਿੱਚ